ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਅਕਾਲ ਅਕੈਡਮੀ ਬਾਸਰਕੇ ਤੋਂ ਰਣਜੀਤ ਦੀ ਟੀਚਰ ਗੱਲ ਕਰਦੀ ਪਈ ਹਾਂ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਕਿ ਤੁਹਾਡਾ ਬੱਚਾ ਠੀਕ ਨਹੀਂ ਆ ਅਤੇ ਉਹਨੂੰ ਆਣ ਕੇ ਅਤੇ ਲੈ ਜਾਓ ਤੁਸੀਂ ਫੀਵਰ ਬਹੁਤ ਹੋਇਆ ਹੈ ਹਾਂਜੀ ਪਤਾ ਨਹੀਂ ਅਸੀਂ ਤਾਂ ਬਹੁਤ ਧਿਆਨ ਰੱਖਦੇ ਹਾਂ ਖਾਣ ਪੀਣ 'ਚ ਮੇ ਬੀ ਕੋਈ ਪ੍ਰੋਬਲਮ ਹੋ ਗਈ ਹੋਵੇ ਹਾਂਜੀ ਨਹੀਂ ਸਕੂਲ ਦੀ ਵੈਨ ਤਾਂ ਨਹੀਂ ਆ ਸਕਦੀ ਕਿਉਂਕਿ ਛੁੱਟੀ ਤਾਂ ਹੁਣ ਚਾਰ ਵਜੇ ਹੋਣੀ ਆ ਤੁਸੀਂ ਇਸ ਤਰ੍ਹਾਂ ਨਹੀਂ ਨਾ ਮਤਲਬ ਤੁਸੀਂ ਆਣ ਕੇ ਲੈ ਜਾਓ ਹਾਂਜੀ ਹਾਂਜੀ ਹਾਂਜੀ ਓਕੇ ਓਕੇ ਸਰ